ਹਾਂਜੀ ਮੇਰੇ ਕੋਲ ਮੇਰੀ ਪੁਰਾਣੀ ਫੋਟੋਆਂ ਦੀ ਹਾਰਡ ਕੋਪੀ ਪਈ ਹੈ ਜਿਸ ਵਿੱਚ ਕਿ ਮੇਰੀਆਂ ਬਚਪਨ ਦੀਆ ਫੋਟੋਆਂ ਹਨ ਜਿਸ ਵਿੱਚ ਕਿ ਮੈਂ ਆਪਣੇ ਆਪ ਨੂੰ ਇੱਕ ਅਲੱਗ ਹੀ ਤਰ੍ਹਾਂ ਨਾਲ ਵੇਖਦੀ ਹਾਂ ਮੇਰੇ ਛੋਟੇ ਤੋਂ ਬਚਪਨ ਤੋਂ ਲੈ ਕੇ ਵੱਡੇ ਹੁੰਦੇ ਦੀਆਂ ਸਾਰੀਆਂ ਤਸਵੀਰਾਂ ਉਸ ਵਿੱਚ ਹਨ ਅਤੇ ਇਸ ਵਿੱਚ ਫ਼ਰਕ ਇੰਨਾਂ ਹੀ ਹੈ ਕਿ ਮੇਰੀਆਂ ਜਿਹੜੀਆਂ ਨਵੀਆਂ ਫੋਟੋਆਂ ਨੇ ਉਹ ਸਾਰੀਆਂ ਮੇਰੀਆਂ ਅੱਜ ਦੇ ਜ਼ਮਾਨੇ ਦੇ ਨਾਲ ਆ ਪਰ ਜਿਹੜੀਆਂ ਮੈਂ ਪੁਰਾਣੀਆਂ ਫੋਟੋਆਂ ਉਸ ਵਿੱਚ ਮੇਰਾ ਜਿਵੇਂ ਪ ਪੁਰਾਣਾ ਪਹਿਰਾਵਾ ਪੁਰਾਣੇ ਜ਼ਮਾਨੇ ਦੇ ਜਿਵੇਂ ਪਹਿਰਾਵੇ ਹੁੰਦੇ ਸੀ ਉਹ ਸਾਰੇ ਮੈਂ ਦੇਖ ਸਕਦੀ ਹਾਂ ਪੁਰਾਣੀ ਫੋਟੋਆਂ ਵਿੱਚ ਬਹੁਤ ਸਾਰੀਆਂ ਐਂਵੇ ਦੀਆਂ ਚੀਜ਼ਾਂ ਹਨ ਜਿਹੜੀਆਂ ਮੇਰੀ ਇਸ ਟਾਇਮ ਕੋ ਵੀ ਮੇਰੇ ਕੋਲ ਨਹੀਂ ਹਨ ਪੁਰਾਣੇ ਸਮੇਂ ਵਿੱਚ ਜੋ ਜੋ ਹੁੰਦਾ ਸੀ ਉਹ ਉਹਨਾਂ ਫੋਟੋਆਂ ਵਿੱਚ ਕੈਦ ਹੈ ਅਤੇ ਮੈਂ ਉਹਨਾਂ ਫੋਟੋਆਂ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹਾਂ ਉਸ ਫੋਟੋਆਂ ਵਿੱਚ ਮੇਰੀਆਂ ਬ ਬਹੁਤ ਸਾਰੀਆਂ ਭਾਵਨਾਵਾਂ ਹਨ ਜਿਨ੍ਹਾਂ ਨੂੰ ਮੈਂ ਇੱਦਾਂ ਬੋਲ ਕੇ ਦਰਸਾ ਨਹੀਂ ਸਕਦੀ